ਤੇਰਾਂ ਚਾਰ ਦੋ ਹਜ਼ਾਰ ਨੌਂ ਪੰਦਰਾਂ ਅੱਠ ਦੋ ਹਜ਼ਾਰ ਦਸ ਸੌਲਾਂ ਦਸ ਦੋ ਹਜ਼ਾਰ ਉੱਨੀ ਇੱਕੀ ਨੌਂ ਦੋ ਹਜ਼ਾਰ ਬਾਈ ਗਿਆਰਾਂ ਅੱਠ ਦੋ ਹਜ਼ਾਰ ਤੇਈ